ਮੈਨੂੰ ਚਿੱਤਰ ਬਣਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਚਿੱਤਰ ਜਿਹੜੇ ਹੈਗੇ ਆ ਉਹ ਸ਼ੌ ਮਤਲਬ ਆਪਣੀ ਸਕੂਲ ਟਾਈਮ ਤੋਂ ਬਣਾਉਂਦੀ ਹਾਂ ਚਿੱਤਰ ਬਣਾਉਣ ਦੀ ਮਤਲਬ ਚਿੱਤਰ ਬਣਾਉਣਾ ਮੈਂ ਆਪਣੇ ਸਕੂਲ ਤੋਂ ਹੀ ਸ਼ੁਰੂ ਕੀਤਾ ਸੀ ਸਕੂਲ ਦੇ ਵਿੱਚ ਵੀ ਮੈਂ ਮਤਲਬ ਬਹੁਤ ਸਾਰੇ ਚਾਰਟ ਬਣਾਉਂਦੀ ਹੁੰਦੀ ਸੀ ਬਹੁਤ ਸਾਰੀਆਂ ਜੋ ਸਕੂਲ ਵਿੱਚ ਐਕਟੀਵਿਟੀਜ਼ ਦਿੱਤੀਆਂ ਜਾਂਦੀਆਂ ਸੀਗੀਆਂ ਹਰ ਸਬਜੈਕਟ ਦੀਆਂ ਜਿਵੇਂ ਕਿ ਸਾਇੰਸ ਮੈਥ ਔਰ ਐਸਐਸਟੀ ਇਹਨਾਂ ਦੇ ਐਸਐਸਟੀ ਦੇ ਭੂਗੋਲ ਦੇ ਮਤਲਬ ਐਸਐਸਟੀ ਦੇ ਵਿੱਚ ਭੂਗੋਲ ਵਿਸ਼ਾ ਉਸਦੇ ਬਹੁਤ ਸਾਰੇ ਜਿਹੜੇ ਚਾਰਟ ਸਾਨੂੰ ਦਿੱਤੇ ਜਾਂਦੇ ਸੀ ਇਸ ਤਰ੍ਹਾਂ ਜਿਹੜੀ ਮੇਰੀ ਚਿੱਤਰ ਮਤਲਬ ਮੇਰੀ ਬਣਾਉਣ ਦੀ ਜਿਹੜੀ ਉਹ ਹੈ ਅਤੇ ਬਹੁਤ ਜ਼ਿਆਦਾ ਮਤਲਬ ਅਸਰ ਪਿਆ ਅਤੇ ਮੈਂ ਚਿੱਤਰ ਬਣਾਉਣੇ ਸ਼ੁਰੂ ਕੀਤੇ ਅਤੇ ਮਤਲਬ ਮੇਰੀ ਚਿੱਤਰ ਬਣਾਉਣ ਦੇ ਵਿੱਚ ਬਹੁਤ ਸਾਰੀਆਂ ਸ਼ੁਰੂ ਸ਼ੁਰੂ ਦੇ ਵਿੱਚ ਮੁਸ਼ਕਿਲਾਂ ਵੀ ਆਈਆਂ ਪਰ ਮੈਂ ਆਪਣੀਆਂ ਜਿਹੜੀਆਂ ਇਹ ਜਿਹੜੀਆਂ ਗਲਤੀਆਂ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਇਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਮਤਲਬ ਇਹਨਾਂ 'ਤੇ ਕੰਮ ਕੀਤਾ ਅਤੇ ਹੁਣ ਮੈਂ ਆਪਣੀਆਂ ਗਲਤੀਆਂ ਨੂੰ ਹੌਲੀ ਹੌਲੀ ਘਟਾ ਰਹੀ ਹਾਂ ਕਿ ਮੇਰੀਆਂ ਜਿਹੜੀਆਂ ਗਲਤੀਆਂ ਹੈ ਇਹਨਾਂ ਤੋਂ ਮਤਲਬ ਮੈਂ ਆਪਣੀ ਹਰ ਇੱਕ ਗਲਤੀ ਤੋਂ ਇੱਕ ਨਵੀਂ ਚੀਜ਼ ਸਿੱਖਦੀ ਹਾਂ ਅਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਿਹੜੀ ਨੇ ਇਹ ਗਲਤੀ ਕੀਤੀ ਹੈ ਇਸ ਗਲਤੀ ਤੋਂ ਬਾਅਦ ਮੈਂ ਅੱਗੇ ਕੋਈ ਹੋਰ ਗਲਤੀ ਨਾ ਕਰਾਂ ਅਤੇ ਮੈਂ ਆਪਣਾ ਚਿੱਤਰ ਮਤਲਬ ਅੱਗੇ ਤੋਂ ਅੱਗੇ ਹੋਰ ਵਧੀਆ ਕਰਾਂ ਅਤੇ ਮੈਂ ਅਜਿਹਾ ਚਿੱਤਰ ਬਣਾਉਣਾ ਪਸੰਦ ਕਰਦੀ ਹਾਂ ਕਿ ਜੋ ਮੇਰਾ ਚਿੱਤਰ ਦੇਖ ਕੇ ਦੂਜੇ ਬੰਦੇ ਨੂੰ ਮੇਰੇ ਚਿੱਤਰ ਤੋਂ ਕੋਈ ਸੰਦੇਸ਼ ਮਿਲੇ ਕੋਈ ਸਿੱਖਿਆ ਮਿਲੇ ਮੈਂ ਅਜਿਹਾ ਚਿੱਤਰ ਬਣਾਉਣਾ ਪਸੰਦ ਕਰਦੀ ਹਾਂ ਕਿ ਚਿੱਤਰ ਬਣਾਉਣ ਸਮੇਂ ਬਹੁਤ ਸਾਰੀਆਂ ਮੈਂ ਗਲਤੀਆਂ ਵੀ ਕਰਦੀ ਹਾਂ ਜਿਵੇਂ ਕਿ ਮੈਂ ਇੱਕ ਟਾਈਮ 'ਤੇ ਮਤਲਬ ਫੋਕਸ ਨਹੀਂ ਕਰ ਪਾਉਂਦੀ ਇੱਕ ਟਾਈਮ 'ਤੇ ਮਤਲਬ ਉਹਨਾਂ ਧਿਆਨ ਕੇਂਦਰਿਤ ਨਹੀਂ ਕਰ ਸਕਦੀ ਮੇਰਾ ਧਿਆਨ ਭਟਕਦਾ ਰਹਿੰਦਾ ਮੈਂ ਸੋਚਦੀ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਮਤਲਬ ਮੇਰਾ ਮਤਲਬ ਮੈਂ ਆਪਣੇ ਚਿੱਤਰ ਨੂੰ ਵਧੀਆ ਕਰਨ ਲਈ ਹਰ ਇੱਕ ਢੰਗ ਤਰੀਕੇ ਦੀ ਵਰਤੋਂ ਕਰਦੀ ਹੈ ਕਿ ਹਾਂ ਕਿ ਕਿਹੜੀ ਚੀਜ਼ ਮੈਂ ਇੱਕ ਵੀ ਯੂਜ ਕਰਾਂ ਕਿਆ ਕਰਾਂ ਕਿ ਹਾਂ ਇਹ ਹੋਰ ਵਧੀਆ ਬਣ ਜੇ ਕਿਆ ਕਰਾਂ ਕਿ ਹੋਰ ਵਧੀਆ ਬਣ ਜੇ ਕਿਸੇ ਨੇ ਕਿਹਾ ਏ ਮੈਂ ਹਰ ਵਾਰ ਆਪਣੀ ਜਿਹੜੀਆਂ ਗਲਤੀਆਂ ਜਿਹੜੀਆਂ ਮੈਂ ਕਰਦੀ ਹਾਂ ਮਤਲਬ ਕਰ ਰਹੀ ਸੀ ਪਹਿਲਾਂ ਤੋਂ ਤਾਂ ਹੁਣ ਕਰ ਰਹੀ ਹਾਂ ਆਪਣੀ ਗਲਤੀਆਂ ਨੂੰ ਸੁਧਾਰਨ ਦੀ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਅਤੇ ਇਸ ਤਰ੍ਹਾਂ ਹੀ ਜਿਹੜੀ ਮੇਰੀ ਚਿੱਤਰਕਾਰੀ ਹੈ ਉਹ ਹੋਰ ਅੱਗੇ ਤੋਂ ਅੱਗੇ ਤੋਂ ਅੱਗੇ ਪ੍ਰਫੁੱਲਿਤ ਹੋਈ ਜਾ ਰਹੀ ਹੈ